ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਮੌਸਮ ਦਰਮਿਆਨਾ ਜਿਹਾ ਮੌਸਮ ਹੈ ਨਾ ਜ਼ਿਆਦਾ ਇੱਥੇ ਠੰਢ ਹੀ ਲੋਕਾਂ ਨੂੰ ਇਫੈਕਟ ਕਰਦੀ ਹੈ ਅਤੇ ਨਾ ਜ਼ਿਆਦਾ ਹੀ ਇੱਥੇ ਗਰਮੀ ਜੋ ਹੈ ਲੋਕਾਂ ਨੂੰ ਇੰਨਾਂ ਇਫੈਕਟ ਕਰਦੀ ਹੈ ਜਿਹੜੇ ਮੌਸਮ ਦੇ ਵਿੱਚ ਨੇ ਲੋਕ ਆਪਣੇ ਡੇਲੀ ਰੂਟੀਨ ਦੇ ਕੰਮ ਉੱਦਾਂ ਹੀ ਕਰਦੇ ਆ ਜਿੱਦਾਂ ਉਹ ਜਾਂ ਗਰਮੀ ਦੇ ਵਿੱਚ ਕਰਦੇ ਜਾਂ ਸਰਦੀ ਦੇ ਵਿੱਚ ਕਰਦੇ ਆ ਇੱਥੇ ਮੌਸਮ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਹਾਂ ਚੇਂਜ ਆਈ ਹੈ ਉਹ ਇਹ ਹੈ ਕਿ ਜਿਹੜੇ ਪਹਿਲਾਂ ਹੁੰਦੇ ਸੀਗੇ ਇੱਥੇ ਟ੍ਰੀਜ਼ ਵਗੈਰਾ ਬਹੁਤ ਜ਼ਿਆਦਾ ਹੁੰਦੇ ਸੀਗੇ ਗਰੀਨਰੀ ਜ਼ਿਆਦਾ ਹੁੰਦੀ ਸੀਗੀ ਜਿਹਦੇ ਕਰਕੇ ਜਿਹੜੀ ਰੇਨਫੋਲ ਹੈ ਜਾਂ ਮੀਂਹ ਉਹ ਜ਼ਿਆਦਾ ਹੁੰਦਾ ਸੀ ਬਟ ਜਿਵੇਂ ਹੁਣ ਆਪਾਂ ਦੇਖਦੇ ਹਾਂ ਇਕੱਲੇ ਫਤਿਹਗੜ੍ਹ ਸਾਹਿਬ ਦੀ ਨਹੀਂ ਗੱਲ ਕਰਦੇ ਓਵਰਆਲ ਆਪਾਂ ਜੇ ਆਪਾਂ ਸਾਰੇ ਵਰਲਡ ਦੀ ਗੱਲ ਕਰੀਏ ਤਾਂ ਗਲੋਬਲ ਵਾਰਮਿੰਗ ਨੇ ਇਹ ਚੀਜ਼ ਬਹੁਤ ਜ਼ਿਆਦਾ ਇਫੈਕਟ ਕੀਤੀ ਆ ਕਿਉਂਕਿ ਹੁਣ ਦੇ ਟਾਈਮ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਜੇ ਮੀਂਹ ਪੈਂਦੇ ਆ ਤਾਂ ਮੀਂਹ ਬਹੁਤ ਜ਼ਿਆਦਾ ਪੈਂਦਾ ਗਰਮੀ ਹੈ ਤਾਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਸਰਦੀ ਹੈ ਤਾਂ ਸਰਦੀ ਬਹੁਤ ਜ਼ਿਆਦਾ ਪੈਂਦੀ ਹੈ ਸੋ ਬੇਸਿਕਲੀ ਜਿਹੜੀ ਇਹ ਚੀਜ਼ ਹੈ ਇਕੱਲੇ ਫਤਿਹਗੜ੍ਹ ਸਾਹਿਬ ਨੂੰ ਨਹੀਂ ਇਫੈਕਟ ਕੀਤੀ ਇਹ ਸਾਰੇ ਓਵਰਆਲ ਵਰਲਡ ਨੂੰ ਇਫੈਕਟ ਕੀਤੀ ਆ ਹਾਂ ਗਰੀਨਰੀ ਕਰਕੇ ਇੱਥੇ ਥੋੜ੍ਹਾ ਜਿਹਾ ਫਰਕ ਪਿਆ